ਭਾਰਤ ਦੀ ਸੱਭਿਆਚਾਰ ਪਰੰਪਰਾਵਾਂ ਬਹੁਤ ਸਾਰੀਆਂ ਹਨ ਜਿਵੇਂ ਕਿ ਗੱਲ ਕਰੀਏ ਬੱਚੇ ਦੇ ਜਨਮ ਤੋਂ ਲੈ ਕੇ ਸਟਾਰਟ ਹੋ ਜਾਂਦੇ ਨੇ ਅਤੇ ਜਦੋਂ ਤੱਕ ਬੰਦੇ ਦੀ ਮੌਤ ਨਹੀਂ ਹੁੰਦੀ ਉਦੋਂ ਤੱਕ ਇਹ ਪਰੰਪਰਾਵਾਂ ਚੱਲਦੀਆਂ ਰਹਿੰਦੀਆਂ ਨੇ ਜਿਵੇਂ ਕਿ ਗੱਲ ਕਰੀਏ ਬੱਚੇ ਦੇ ਜਨਮ ਸਮੇਂ ਦੀ ਬੱਚੇ ਦੇ ਜਨਮ ਸਮੇਂ ਉਸਨੂੰ ਗੁੜ੍ਹਤੀ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹਦਾ ਨਾਮ ਰੱਖਿਆ ਜਾਂਦਾ ਨਾਮ ਰੱਖਣ ਤੋਂ ਬਾਅਦ ਲੋਹੜੀ ਵੰਡੀ ਜਾਂਦੀ ਹੈ ਲੋਹੜੀ ਵੰਡਣ ਤੋਂ ਬਾਅਦ ਜਦੋਂ ਬੱਚਾ ਹੌਲੀ ਹੌਲੀ ਬੜਾ ਹੁੰਦਾ ਜਾਂਦਾ ਤਾਂ ਹੋਰ ਬਹੁਤ ਸਾਰੇ ਮੱਥੇ ਟੇਕੇ ਜਾਂਦੇ ਹਨ ਜਿਵੇਂ ਕਿ ਮਾਤਾ ਦੇ ਹੋ ਗਿਆ ਕਿਤੇ ਪੀਰਾਂ ਦੇ ਹੋ ਗਿਆ ਜਾਂ ਹੋਰ ਗੁਰਦੁਆਰਾ ਸਾਹਿਬ ਵਿੱਚ ਹੋ ਗਿਆ ਜਾਂ ਕੋਈ ਸੁੱਖ ਮੰਗ ਲੈਂਦੇ ਨੇ ਉਹਨਾਂ ਦਾ ਮੱਥਾ ਟੇਕਦੇ ਨੇ ਇੱਦਾਂ ਹੀ ਜਦੋਂ ਬੱਚਾ ਬੜਾ ਹੋ ਜਾਂਦਾ ਉਹਦੀ ਵਿਆਹ ਦੀ ਉਮਰ ਹੋ ਜਾਂਦੀ ਹੈ ਤਾਂ ਉਹ ਸਾਰੀਆਂ ਵਿਆਹ ਵਾਲੀਆਂ ਰਸਮਾਂ ਹੁੰਦੀਆਂ ਨੇ ਉਸ ਤੋਂ ਬਾਅਦ ਜਦੋਂ ਅੱਗੇ ਅੱਗੇ ਉਸਦੀ ਗੋਦ ਭਰਾਈ ਦੇ ਬਾਅਦ ਗੋਦ ਭਰਾਈ ਦੇ ਹੁੰਦੇ ਨੇ ਰਸਮਾਂ ਉਸ ਤੋਂ ਬਾਅਦ ਜਦੋਂ ਉਹ ਸਾਰਾ ਮਤਲਵ ਕਿ ਜ਼ਿੰਦਗੀ ਬਤੀਤ ਕਰ ਲੈਂਦਾ ਤਾਂ ਉਸ ਤੋਂ ਬਾਅਦ ਮੌਤ ਹੋ ਜਾਂਦੀ ਹੈ ਬੰਦੇ ਦੀ ਤਾਂ ਉਸ ਸਮੇਂ ਮੌਤ ਦੀ ਜੋ ਵੀ ਰਸਮਾਂ ਹੁੰਦੀਆਂ ਨੇ ਉਹ ਸਾਰੀਆਂ ਨਿਭਾਈਆਂ ਜਾਂਦੀਆਂ ਨੇ ਇੱਦਾਂ ਹੀ ਭਾਰਤ ਦੀ ਜਿਹੜੀ ਤੁਲਨਾ ਹੈ ਉਹ ਬਾਕੀ ਸੰਸਾਰ ਵਿੱਚ ਬਹੁਤ ਜ਼ਿਆਦਾ ਅਲੱਗ ਹੈ ਜਿਵੇਂ ਕਿ ਗੱਲ ਕਰੀਏ ਭਾਰਤ ਦਾ ਪਹਿਰਾਵਾ ਜਿਹੜਾ ਉਹ ਵੀ ਬਹੁਤ ਜ਼ਿਆਦਾ ਵੱਖਰਾ ਬਾਹਰਲੇ ਦੇਸ਼ਾਂ ਨਾਲੋਂ ਵੈਸਟਰਨ ਕਲਚਰ ਨਾਲੋਂ ਆਪਣਾ ਜਿਹੜੇ ਅਪਣ ਉਹ ਪਹਿਨਣਾ ਉਹ ਸਾੜੀ ਹੋ ਗਈ ਸੂਟ ਹੋ ਗਏ ਜਾਂ ਕੁੜਤਾ ਪਜਾਮਾ ਹੋ ਗਿਆ ਚਾਦਰਾ ਹੋ ਗਿਆ ਧੋਤੀ ਹੋ ਗਈ ਇੱਦਾਂ ਦੀਆਂ ਚੀਜ਼ਾਂ ਪਹਿਨਦੇ ਨੇ ਅਤੇ ਜਿਹੜੇ ਵੈਸਟਰਨ ਨੇ ਉਹ ਜ਼ਿਆਦਾਤਰ ਸੂਟ ਹੋ ਗਏ ਜਾਂ ਆਪਣੇ ਪੈਂਟ ਕੋਟ ਹੋ ਗਏ ਜੀਨਸ ਹੋ ਗਈ ਪੈਂਟਾਂ ਹੋ ਗਈਆਂ ਸ਼ਰਟ ਹੋ ਗਈ ਇੱਦਾਂ ਦੀਆਂ ਚੀਜ਼ਾਂ ਪਹਿਨਦੇ ਨੇ ਅਤੇ ਜਿਹੜੇ ਭਾਰਤ ਵਾਲੇ ਲੋਕ ਹੈ ਉਹ ਥੋੜ੍ਹਾ ਜਿਹਾ ਦੇਸੀ ਟਾਈਪ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਕੁੜਤਾ ਹੋ ਗਿਆ ਚਾਦਰਾ ਹੋ ਗਿਆ ਇਹ ਜ਼ਿਆਦਾ ਪਹਿਨਣਾ ਪਸੰਦ ਕਰਦੇ ਨੇ ਪਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਹੈ ਉਹ ਤਾਂ ਹੁਣ ਸਾਰਾ ਕੁਛ ਹੀ ਵੈਸਟਰਨ ਦੇ ਵਿੱਚ ਜਾ ਰਹੀ ਹੈ ਜੀਨਾਂ ਪਾ ਰਹੀ ਹੈ ਪੈਂਟਾਂ ਪਾ ਰਹੀ ਹੈ ਸ਼ਰਟਾਂ ਪਾ ਰਹੀ ਹੈ ਅਤੇ ਜਿਹੜੇ ਆਪਣੇ ਦੇਸੀ ਸੀਗੇ ਕੁੜਤਾ ਪਜਾਮਾ ਹੋ ਗਿਆ ਚਾਦਰਾ ਹੋ ਗਿਆ ਧੋਤੀ ਹੋ ਗਈ ਲੂੰਗੀ ਹੋ ਗਈ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡਦੇ ਜਾ ਰਹੇ ਨੇ